ਮੈਨੇਂਜਰ ਸਾਹਿਬ ਮੈਂ ਕੋਫ਼ੀ ਦਾ ਔਡਰ ਦਿੱਤਾ ਸੀ ਪੰਜ ਕੋਫੀ ਔਡਰ ਨੰਬਰ ਪੰਜ ਅਸੀਂ ਹਾਲ ਵਿੱਚ ਬੈਠੇ ਹੋਏ ਹਾਂ ਅਸੀਂ ਕਾਰੋਬਾਰ ਬਾਰੇ ਕੋਈ ਕੰਮ ਕਰ ਰਹੇ ਹਾਂ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਕੋਫੀ ਜ਼ਿਆਦਾ ਦੇਰ ਤੱਕ ਗਰਮ ਰਹੇ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਕੋਫੀ ਦੀ ਪੈਕਿੰਗ ਜਾਂ ਤਾਂ ਸੀਲ ਵਾਲੇ ਕੱਪ ਵਿੱਚ ਭੇਜ ਦਿਓ ਜਾਂ ਫਿਰ ਥਰਮੋਸ 'ਚ ਅਤੇ ਜਾਂ ਫਿਰ ਸਾਨੂੰ ਬਿਜਲੀ ਵਾਲੀ ਕੇਤਲੀ ਦੇ ਦੇਵੋ ਤਾਂ ਕਿ ਇਹ ਕੋਫੀ ਜ਼ਿਆਦਾ ਦੇਰ ਤੱਕ ਗਰਮ ਰਹੇ ਕਿਉਂਕਿ ਸਾਨੂੰ ਨਹੀਂ ਪਤਾ ਕਿ ਅਸੀਂ ਕਿੰਨਾ ਚਿਰ ਹੋਰ ਕੰਮ ਕਰੀਏ ਇਸ ਲਈ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਨੂੰ ਜ਼ਿਆਦਾ ਦੇਰ ਤੱਕ ਗਰਮ ਰੱਖਣ ਲਈ ਕੋਫੀ ਵਾਸਤੇ ਕੋਈ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਕੇ ਦਿਓਗੇ ਇਸ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂਗਾ ਕਿ ਤੁਸੀਂ ਕੋਈ ਨਾ ਕੋਈ ਹੱਲ ਜ਼ਰੂਰ ਕੱਢੋਗੇ ਧੰਨਵਾਦ